ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅਸੀਂ ਤਾਂ ਭੈਣ ਜੀ ਬਜਾਜ ਡਾਇਰੀ ਤੋਂ ਦੁੱਧ ਲੈ ਕੇ ਆਈਦਾ ਆ ਇੱਥੇ ਸਾਡੇ ਨੀਅਰ ਬਾਈ ਆ ਅਤੇ ਵਧੀਆ ਦੁੱਧ ਦਿੰਦੇ ਆ ਅਸੀਂ ਸਾਨੂੰ ਪਿਛਲੇ ਦਸ ਸਾਲਾਂ ਤੋਂ ਉਹਨਾਂ ਤੋਂ ਓ ਦੁੱਧ ਲਿਆਉਂਦੇ ਹਾਂ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਦੁੱਧ 'ਤੇ ਮਲਾਈ ਵੀ ਬਹੁਤ ਵਧੀਆ ਆਉਂਦੀ ਆ ਅਤੇ ਤੁਸੀਂ ਕਿਹੜਾ ਦੁੱਧ ਲੈਣਾ ਮੱਝ ਦਾ ਲੈਣਾ ਕਿ ਗਾਂ ਦਾ ਲੈਣਾ ਵਾਂ ਮੱਝ ਦਾ ਦੁੱਧ ਤਾਂ ਵੈਸੇ ਪੈਂਹਠ ਰੁਪਏ ਕਿੱਲੋ ਮਿਲਦਾ ਆ ਅਤੇ ਗਾਂ ਦਾ ਦੁੱਧ ਪਚਵੰਜਾ ਰੁਪਿਆ ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਇਹਨਾ ਦੇ ਤਾਂ ਆਪ ਜਾਣਾ ਪੈਣਾ ਤੁਹਾਨੂੰ ਦੁੱਧ ਲੈਣ ਕੋਈ ਨਾ ਕੱਲ੍ਹ ਨੂੰ ਮੈਂ ਸਵੇਰ ਨੂੰ ਜਾਣਾ ਤੁਸੀਂ ਮੇਰੇ ਨਾਲ ਚਲ ਜਿਓ ਮੈਂ ਸਵਾ ਕੁ ਨੌ ਵਜੇ ਜਾਂਦੀ ਹੁੰਦੀ ਹਾਂ

ਹਾਂਜੀ ਹਾਂਜੀ ਹਾਂਜੀ ਹੋਰ ਦੋ ਦੇਸੀ ਘਿਓ ਵਗੈਰਾ ਵੀ ਸਭ ਕੁਛ ਉਹਨਾਂ ਦੀ ਓ ਮਿਲ ਜਾਂਦਾ ਵਧੀਆ ਭਾਅ 'ਤੇ ਮਿਲ ਜਾਂਦਾ ਆ ਮੈਮ ਨਹੀਂ ਨਹੀਂ ਨਹੀਂ ਨਹੀਂ ਤਾਜਾ ਜਮਾਉਂਦੇ ਆਪ ਦੀਆਂ ਉਹਨਾਂ ਦੀਆਂ ਮੱਝਾਂ ਗਾਵਾਂ ਕੋਲ ਡਾਇਰੀ ਉਹਨਾਂ ਦੀ ਆਪਣੀ ਆ ਸਾਰੇ ਨਹੀਂ ਨਹੀਂ ਮੈ ਤੁਸੀਂ ਮੇਰੇ ਨਾਲ ਚੱਲਿਓ ਭੈਣ ਜੀ ਬਹੁਤ ਵਧੀਆ ਆ ਉੱਥੇ ਤਾਂ ਚਲੋ ਠੀਕ ਆ ਫਿਰ